ਸਾਡੇ ਰਾਜ ਵਿੱਚ ਇੱਕ ਤਾਂ ਕਈ ਤਰ੍ਹਾਂ ਦੀਆਂ ਐਗਜੀਬਿਸ਼ਨ ਹੁੰਦੀਆਂ ਹਨ ਜਿੱਥੇ ਦੂਰ ਦੂਰ ਤੋਂ ਕਲਾਕਾਰ ਆ ਕੇ ਆਪਣੇ ਵਿਚਾਰ ਐਰਸਚੇਂਜ ਕਰਦੇ ਹਨ ਅਤੇ ਉਹਦੇ ਨਾਲ ਸਭ ਦਾ ਮਨ ਖੁੱਲਦਾ ਹੈ ਅਤੇ ਹੋਰ ਕਲਾ ਕਰਨ ਦਾ ਮਾਹੌਲ ਬਣਦਾ ਹੈ ਬਾਕੀ ਲੋਕਲ ਕਈ ਕਾਲਜ ਹਨ ਯੂਨੀਵਰਸਿਟੀਜ਼ ਹਨ ਜਿੱਥੇ ਇਹਦੀ ਪੜ੍ਹਾਈ ਵੀ ਮਿਲਦੀ ਹੈ ਬਾਕੀ ਇੱਦਾਂ ਦਾ ਹੀ ਇੱਕ ਇੱਕ ਈਵੈਂਟ ਹੈ ਜੋ ਮੈਂ ਪਿਛਲੇ ਸਾਲ ਅਟੈਂਡ ਕੀਤਾ ਸੀ ਉਸ ਬਾਰੇ ਮੈਂ ਦੱਸ ਸਕਦਾ ਆਪਣੇ ਇਹ ਸਾਡਾ ਸ਼ਹਿਰ ਅੰਮ੍ਰਿਤਸਰ ਤੋਂ ਥੋੜ੍ਹਾ ਦੂਰ ਅਟਾਰੀ ਦੇ ਕੋਲ ਇੱਕ ਪਿੰਡ ਹੈ ਜਿੱਥੇ ਕੀ ਇੱਕ ਆਰਟ ਫੈਸਟੀਵਲ ਹੁੰਦਾ ਹੈ ਮੇਲਾ ਨਾਮ ਤੋਂ ਹਰ ਕੁਛ ਕੁਛ ਹਰ ਕੁਛ ਸਾਲਾਂ ਨੂੰ ਅਤੇ ਉੱਥੇ ਉਹ ਦੂਰੋਂ ਦੂਰੋਂ ਅਲਗ ਅਲਗ ਦੇਸ਼ਾਂ ਤੋਂ ਕਲਾਕਾਰਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ ਫੋਟੋਗ੍ਰਾਫਰ ਹੋ ਗਏ ਪੇਂਟਿੰਗ ਕਰਨ ਵਾਲੇ ਹੋ ਗਏ ਫੈਵਰਿਕ ਵਾਲੇ ਹੋ ਗਏ ਅਲਗ ਅਲਗ ਤਰ੍ਹਾਂ ਦੇ ਕਲਾਕਾਰ ਅਤੇ ਉਹ ਸਭ ਮਿਲ ਕੇ ਉੱਥੇ ਕੋਈ ਨਾ ਕੋਈ ਟੋਪਿਕ 'ਤੇ ਐਕਸੀਬਿਸ਼ਨ ਲਗਾਉਂਦੇ ਹਨ ਆਪਣੇ ਵਿਚਾਰ ਸ਼ੇਅਰ ਕਰਦੇ ਹਨ ਜਿਹਦੇ ਨਾਲ ਕਾਫ਼ੀ ਵਧੀਆ ਕੁਛ ਨਾ ਕੁਛ ਨਿਕਲ ਕੇ ਆਉਂਦਾ ਹੈ ਸਾਨੂੰ ਵੀ ਮੌਕਾ ਮਿਲਿਆ ਸੀ ਉੱਥੇ ਜਾਣ ਦਾ ਅਤੇ ਕਾਫ਼ੀ ਵਧੀਆ ਮਾਹੌਲ ਸੀਗਾ ਕਾਫ਼ੀ ਸਿੱਖਣ ਨੂੰ ਮਿਲਿਆ ਕਿ ਦੁਨੀਆਂ 'ਚ ਲੋਕ ਕਿਸ ਕਿਸ ਤਰ੍ਹਾਂ ਸੋਚਦੇ ਹਨ ਅਤੇ ਇਹ ਤਾਂ ਬਸ ਇੱਕ ਐਜੀਬਿਸ਼ਨ ਜਾਂ ਇੱਕ ਜਗ੍ਹਾ ਹੈ ਜਿੱਥੇ ਇੱਦਾਂ ਹੋ ਰਿਹਾ ਹੈ ਅਤੇ ਇੱਦਾਂ ਕਈ ਹੋਰ ਜਗ੍ਹਾਵਾਂ ਨ ਹਨ ਜਿੱਥੇ ਕਾਫ਼ੀ ਕੁਛ ਹੋ ਰਿਹਾ ਹੈ ਦੇਸ਼ ਵਿੱਚ ਰਾਜ ਵਿੱਚ ਅਤੇ ਜਿਸ ਨਾਲ ਦੁਨੀਆ ਸਮਝ ਆਉਂਦੀ ਹੈ